ਹੈਲੋ ਮੈਂ ਸਿਮਰਪ੍ਰੀਤ ਸਿੰਘ ਬੋਲ ਰਿਹਾ ਹਾਂ ਕੀ ਤੁਸੀਂ ਪਿਊਮਾ ਸ਼ੂਜ਼ ਤੋਂ ਬੋਲ ਰਹੇ ਹੋ ਮੈਂ ਤੁਹਾਡੇ ਨਾਲ ਇੱਕ ਰਿਵੀਊ ਸਾਂਝਾ ਕਰਨਾ ਚਾਹੁੰਦਾ ਹਾਂ ਜੋ ਕਿ ਮੈਂ ਹਾਲ ਹੀ ਵਿੱਚ ਤੁਹਾਡੇ ਤੋਂ ਮੰਗਵਾਏ ਬੂਟਾਂ ਤੋਂ ਫੀਲ ਕੀਤਾ ਹੈ ਮੈਨੂੰ ਬਹੁਤ ਹੀ ਜਗ੍ਹਾ ਦੇਖਣ ਤੋਂ ਬਾਅਦ ਤੁਹਾਡੀ ਵੈਬਸਾਈਟ ਉੱਤੇ ਬੂਟ ਵਧੀਆ ਲੱਗੇ ਅਤੇ ਮੈਂ ਦੇਖਦੇ ਸਾਰ ਹੀ ਉਹਨਾਂ ਨੂੰ ਔਡਰ ਕਰ ਦਿੱਤਾ ਮੈਂ ਕਿਉਂਕਿ ਮੈਂ ਉਹਨਾਂ ਨੂੰ ਥੋੜ੍ਹੇ ਦਿਨਾਂ ਬਾਅਦ ਹੀ ਪਾਰਟੀ ਵਿੱਚ ਪਾਉਣਾ ਸੀ ਪਹਿਲਾਂ ਮੈਨੂੰ ਇਹ ਡਰ ਸੀ ਕਿਤੇ ਉਹ ਪਾਰਟੀ ਤੋਂ ਪਹਿਲਾਂ ਆ ਜਾਣਗੇ ਜਾਂ ਨਹੀਂ ਪਰ ਇਹ ਮੈਨੂੰ ਦੇਖ ਕੇ ਇਹ ਬਹੁਤ ਖੁਸ਼ੀ ਹੋਈ ਕਿ ਉਹ ਪਾਰਟੀ ਤੋਂ ਦੋ ਦਿਨ ਪਹਿਲਾਂ ਹੀ ਆ ਗਏ ਮੈਂ ਜਦੋਂ ਉਹਨਾਂ ਨੂੰ ਖੋਲਿਆ ਅਤੇ ਦੇਖਿਆ ਕਿ ਬੂਟ ਵੈਬਸਾਈਟ ਨਾਲੋਂ ਵੀ ਬਹੁਤ ਹੀ ਵਧੀਆ ਲੱਗ ਰਹੇ ਸਨ ਉਹਨਾਂ ਦੀ ਬਨਾਵਟ ਉਹਨਾਂ ਦਾ ਸੋਲ ਬਹੁਤ ਹੀ ਵਧੀਆ ਸੀ ਅਤੇ ਉਹ ਬਹੁਤ ਹੀ ਲਾਈਟ ਵੇਟ ਸੀ ਜੋ ਕਿ ਮੇਰੇ ਪੈਰਾਂ ਨੂੰ ਕਮਫਰਟੇਬਲ ਰਹਿਣਗੇ ਜਦੋਂ ਮੈਂ ਉਹਨਾਂ ਨੂੰ ਪਾਰਟੀ ਵਿੱਚ ਪਾ ਕੇ ਗਿਆ ਤਾਂ ਮੈਨੂੰ ਬਹੁਤ ਸਾਰੇ ਲੋਕਾਂ ਵੱਲੋਂ ਬੂਟਾਂ ਕਰਕੇ ਕੋਂਪਲੀਮੈਂਟ ਮਿਲੇ ਅਤੇ ਸਾਰੇ ਮੈਨੂੰ ਪੁੱਛ ਰਹੇ ਸੀ ਕਿ ਤੂੰ ਬੂਟ ਕਿੱਥੋ ਮੰਗਵਾਏ ਅਤੇ ਮੈਂ ਤੁਹਡੀ ਕੰਪਨੀ ਦਾ ਨਾਮ ਲਿੱਤਾ ਮੈਂ ਇਹ ਬੂਟਾਂ ਵੱਲੋਂ ਬਹੁਤ ਹੀ ਖੁਸ਼ ਹਾਂ ਮੈਂ ਮੈਂ ਬੂਟ ਸਾਰਾ ਦਿਨ ਪਾ ਕੇ ਰੱਖੇ ਤਾਂ ਵੀ ਮੇਰੇ ਪੈਰ ਥੱਕੇ ਨਹੀਂ ਅਤੇ ਮੇਰੇ ਪੈਰਾਂ ਨੂੰ ਬਹੁਤ ਹੀ ਵਧੀਆ ਅਤੇ ਆਰਾਮਦਾਇਕ ਫੀਲ ਹੋਇਆ ਮੈਂ ਤੁਹਾਡੀ ਕੰਪਨੀ ਨੂੰ ਪੋਜ਼ੀਟਿਵ ਰਿਵੀਊ ਦੇਣਾ ਚਾਹੁੰਦਾ ਹਾਂ ਧੰਨਵਾਦ